ਅੱਜ ਕੱਲ੍ਹ ਬਹੁਤ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਪਰ ਜਿਨ੍ਹਾਂ ਵਿੱਚੋਂ ਕਈ ਪਕਵਾਨ ਇੱਦਾਂ ਦੇ ਹਨ ਜਿਹੜੇ ਕਿ ਸਿਹਤ ਦੇ ਲਈ ਬਹੁਤ ਵਧੀਆ ਹਨ ਅਤੇ ਸਾਨੂੰ ਜ਼ਿਆਦਾਤਰ ਉਹਨਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ ਜਿਵੇਂ ਕਿ ਅਸੀਂ ਸਰਦੀਆਂ ਦੇ ਵਿੱਚ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਦੀ ਵਰਤੋਂ ਵੱਧ ਕਰਦੇ ਹਾਂ ਜੋ ਕਿ ਸਿਹਤ ਦੇ ਲਈ ਬਹੁਤ ਵਧੀਆ ਰਹਿੰਦੀ ਹੈ ਇਸ ਤੋਂ ਇਲਾਵਾ ਸਰਦੀਆਂ ਦੇ ਵਿੱਚ ਗਾਜਰ ਦਾ ਹਲਵਾ ਵੀ ਜ਼ਿਆਦਾਤਰ ਬਣਾਇਆ ਜਾਂਦਾ ਹੈ ਜੋ ਕਿ ਸਾਡੇ ਸਰੀਰ ਦੀ ਕਮਜ਼ੋਰੀ ਨੂੰ ਵੀ ਦੂਰ ਕਰਦਾ ਹੈ ਅਤੇ ਖਾਣ ਵਿੱਚ ਵੀ ਵਧੀਆ ਲੱਗਦਾ ਹੈ ਅਤੇ ਗਰਮੀਆਂ ਦੇ ਵਿੱਚ ਜਿਵੇਂ ਕਿ ਘੀਏ ਦੀ ਸਬਜ਼ੀ ਜਾਂ ਜ਼ਿਆਦਾਤਰ ਅਸੀਂ ਮਿਕਸ ਵੈੱਜ ਦੀ ਵਰਤੋਂ ਵੱਧ ਕਰਦੇ ਹਾਂ ਮਿਕਸ ਵੈੱਜ ਦੇ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਫਾਇਦਾ ਇਹ ਹੁੰਦਾ ਕਿ ਸਾਡੇ ਸਰੀਰ ਨੂੰ ਹਰ ਤਰ੍ਹਾਂ ਦੇ ਤੱਤ ਮਿਲ ਜਾਂਦੇ ਨੇ ਇਸ ਤੋਂ ਇਲਾਵਾ ਗਰਮੀਆਂ ਦੇ ਵਿੱਚ ਨਮਕੀਨ ਚਾਵਲ ਵੀ ਸਿਹਤ ਦੇ ਲਈ ਵਧੀਆ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਆਪਾਂ ਜੀਰਾ ਚਾਵਲ ਵੀ ਕਹਿ ਦਿੰਦੇ ਹਾਂ ਇਹ ਵੀ ਸਿਹਤ ਦੇ ਲਈ ਵਧੀਆ ਨੇ ਇਹ ਜ਼ਿਆਦਾਤਰ ਦਹੀਂ ਦੇ ਨਾਲ ਸੇਵਨ ਕਰ ਸਕਦੇ ਹਾਂ ਅਤੇ ਗਰਮੀਆਂ ਦੇ ਵਿੱਚ ਮੂੰਗੀ ਮਸਰ ਦੀ ਦਾਲ ਵੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ ਅਤੇ ਇਹ ਵੈਸੇ ਹਰ ਸੀਜ਼ਨ ਦੇ ਵਿੱਚ ਵਰਤ ਸਕਦੇ ਹਾਂ ਪਰ ਗਰਮੀ ਦੇ ਵਿੱਚ ਜ਼ਿਆਦਾ ਫਾਇਦੇਮੰਦ ਹੈ ਅਤੇ ਮੂੰਗੀ ਦੀ ਦਾਲ ਦਾ ਹਲਵਾ ਵੀ ਬਹੁਤ ਵਧੀਆ ਮੰਨਿਆ ਜਾਂਦਾ ਹੈ ਪਰ ਇਹਦੀ ਵਰਤੋਂ ਜ਼ਿਆਦਾਤਰ ਸਰਦੀਆਂ ਵਿੱਚ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਸੂਜੀ ਦਾ ਹਲਵਾ ਵੀ ਸਿਹਤ ਲਈ ਵਧੀਆ ਹੁੰਦਾ ਹੈ ਅਤੇ ਸਰਦੀਆਂ ਦੇ ਵਿੱਚ ਜ਼ਿਆਦਾਤਰ ਖੀਰ ਘਰਾਂ ਦੇ ਵਿੱਚ ਵੱਧ ਬਣਾਈ ਜਾਂਦੀ ਹੈ ਜੋ ਕਿ ਸਿਹਤ ਦੇ ਲਈ ਵਧੀਆ ਹੈ ਖੀਰ ਦੇ ਵਿੱਚ ਚਾਵਲ ਦੁੱਧ ਘਿਉ ਸਾਰਾ ਕੁਛ ਪੈਂਦਾ ਜੋ ਕਿ ਸਿਹਤ ਦੇ ਲਈ ਵਧੀਆ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਦਾ ਸੇਵਨ ਵੀ ਵੱਧ ਕੀਤਾ ਜਾਂਦਾ ਹੈ